ਹਾਂਜੀ ਸਤਿ ਸ਼੍ਰੀ ਅਕਾਲ ਜੀ ਅੰਜਲੀ ਗੱਲ ਕਰ ਰਹੇ ਹੋ ਜੀ ਮੈਨੂੰ ਤੁਹਾਡਾ ਨੰਬਰ ਮਿਲਿਆ ਸੀਗਾ ਆਨਲਾਈਨ ਪਰਸਨਲ ਫਿਟਨੈਸ ਟਰੇਨਰ ਹੋ ਨਾ ਜੀ ਤੁਸੀਂ ਹਾਂਜੀ ਮੈਂ ਜੀ ਵਜਨ ਘਟਾਉਣਾ ਸੀਗਾ ਆਪਣਾ ਅਤੇ ਮੈਂ ਤਾਂ ਤੁਹਾਡੇ ਨਾਲ ਕੰਟੈਕਟ ਕੀਤਾ ਜੀ ਇਸ ਟਾਈਮ ਤਾਂ ਮੇਰਾ ਵਜਨ ਹੈਗਾ ਪੰਝੱਤਰ ਕਿਲੋ ਅਤੇ ਕੋਸ਼ਿਸ਼ ਹੈ ਜੀ ਮੈਂ ਅਠਾਹਠ ਪੈਂਹਠ ਤੋਂ ਅਠਾਹਠ ਦੇ ਵਿੱਚ ਵਿੱਚ ਕਰ ਲਵਾਂ ਜੇ ਹੋ ਸਕੇ ਤਾਂ ਦੋ ਤਿੰਨ ਮਹੀਨਿਆਂ ਦੇ ਵਿੱਚ ਹਾਂਜੀ ਅੱਛਾ ਜੀ ਅਤੇ ਫਿਰ ਇਹਦੇ ਵਾਸਤੇ ਕੀ ਕੁਛ ਆਪਾਂ ਨੂੰ ਕਰਨਾ ਪੈਣਾ ਹਾਂਜੀ ਹਾਂਜੀ ਹਾਂਜੀ ਹਾਂਜੀ ਹਾਂਜੀ ਹਾਂਜੀ ਹਾਂਜੀ ਹਰੀਆਂ ਸਬਜ਼ੀਆਂ ਜਿਵੇਂ ਹਾਂਜੀ ਠੀਕ ਹੈ ਜੀ ਅਤੇ ਤੁਸੀਂ ਕਿਸ ਟਾਈਮ 'ਤੇ ਸਵੇਰੇ ਜਾਂ ਸ਼ਾਮ ਤੁਸੀਂ ਮੈਨੂੰ ਦੇ ਸਕਦੇ ਹੋ ਜੀ ਟ੍ਰੇਨਿੰਗ ਹਾਂਜੀ ਠੀਕ ਹੈ ਜੀ ਮੈਨੂੰ ਚੱਲ ਜੂਗਾ ਟਾਈਮ ਤਾਂ ਬਲ ਬਿਲਕੁਲ ਠੀਕ ਹੈਗਾ ਅਤੇ ਇਹਦੇ ਵਿੱਚ ਆਪਾਂ ਕੀ ਕੁਛ ਕਰਾਂਗੇ ਸਟਾਰਟਿੰਗ ਸ਼ੁਰੂਆਤ ਕਿਵੇਂ ਹੋਵੇਗੀ ਆਪਣੀ ਅੱਛਾ ਜੀ

ਹਾਂਜੀ ਠੀਕ ਹੈ ਅਤੇ ਮੈਂ ਆਪਣੇ ਵੱਲੋਂ ਵੀ ਸੁਬਹਾ ਦੇ ਟਾਈਮ 'ਤੇ ਕੁਛ ਅਲੱਗ ਤੋਂ ਕਰ ਸਕਦੀ ਜਿਵੇਂ ਹੁਣ ਮੈਂ ਸੈਰ ਤਾਂ ਕਰਨ ਜਾਂਦੀ ਹਾਂ ਹਾਂਜੀ ਇਸ ਠੀਕ ਹੈ ਠੀਕ ਹੈ ਅਤੇ ਜੀ ਦੋ ਤਿੰਨ ਦਿਨ ਦੇ ਵਿੱਚ ਮੈਨੂੰ ਹੈ ਕਿ ਆਪਾਂ ਸ਼ੁਰੂਆਤ ਕਰ ਦੇਈਏ ਅਤੇ ਬਾਕੀ ਮੈਨੂੰ ਤੁਸੀਂ ਡਾਇਟ ਪਲੈਨ ਵੀ ਤੁਸੀਂ ਦਿਉਂਗੇ ਅਲੱਗ ਤੋਂ ਬਣਾ ਕੇ ਹਾਂਜੀ ਠੀਕ ਹੈ ਜੀ ਅਤੇ ਇਹ ਦਵਾਈਆਂ ਖਾਣੀਆਂ ਜੀ ਜ਼ਰੂਰੀ ਹੈ ਅੱਛਾ ਜੀ ਠੀਕ ਹੈ ਜੀ ਠੀਕ ਹੈ ਅਤੇ ਬਾਕੀ ਕਹਿੰਦੇ ਹੈਗੇ ਅੱਜ ਦੇ ਟਾਈਮ 'ਚ ਜਿਵੇਂ ਕਿ ਆਹ ਪ੍ਰੋਟੀਨ ਲੈਣਾ ਅਲੱਗ ਤੋਂ ਤੁਹਾਨੂੰ ਲੈਣਾ ਪੈਣਾ ਅਤੇ ਇਹਦਾ ਫਿਰ

ਠੀਕ ਹੈ ਜੀ ਚਲੋ ਧੰਨਵਾਦ ਜੀ ਫਿਰ ਤੁਹਾਡਾ ਬਹੁਤ ਬਹੁਤ ਬਾਕੀ ਅਸੀਂ ਮਿਲ ਲਵਾਂਗੇ ਅਤੇ ਤੁਸੀਂ ਫਿਰ ਘਰ ਹੀ ਆ ਕੇ ਕਰਵਾ ਸਕਦੇ ਹੋ ਹਾਂਜੀ ਹਾਂਜੀ ਹਾਂਜੀ ਜ਼ਰੂਰ ਜੀ ਇਹ ਤਾਂ ਜ਼ਰੂਰੀ ਹੈ ਠੀਕ ਹੈ ਜੀ ਠੀਕ ਬਾਕੀ ਤੁਸੀਂ ਮੈਨੂੰ ਆਪਣਾ ਪਤਾ ਦੱਸ ਦਿਓ ਤੁਸੀਂ ਵਟਸਐਪ 'ਤੇ ਮੈਨੂੰ ਮੈਂ ਤੁਹਾਨੂੰ ਕਰ ਦੂੰਗੀ ਮੈਸੇਜ ਅਤੇ ਤੁਸੀਂ ਮੈਨੂੰ ਦੱਸ ਦਿਓ ਫਿਰ ਆਪਾਂ ਮਿਲ ਲਵਾਂਗੇ ਜੀ